ਕਲਾ ਕਲਾਸਾਂ ਸਕੂਲ ਵਿੱਚ ਕਲਾ ਕਲਾਸਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ ਜਿੱਥੇ ਅਸੀਂ ਵੱਖ ਵੱਖ ਤਕਨੀਕਾਂ ਸਿੱਖਦੇ ਸੀ ਪਰੇਕ ਪ੍ਰੇਰਕ ਅਧਿਆਪਕ ਮੇਰੇ ਕਲਾ ਅਧਿਆਪਕ ਨੇ ਮੇਰੀ ਕਲਾ ਵਿੱਚ ਰੁਚੀ ਵੇਖ ਕੇ ਮੈਨੂੰ ਬਹੁਤ ਸਾਰੇ ਸਮੇਂ ਪ੍ਰੋਸਾਹਿਤ ਕੀਤਾ ਪ੍ਰਦਰਸ਼ਨੀਆਂ ਸਕੂਲ ਵਿੱਚ ਕਲਾ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ ਸ਼ੌਂਕ ਪ੍ਰੋਗਰਾਮ ਸਕੂਲ ਨੇ ਕਲਾ ਸਿਖਲਾਈ ਪ੍ਰੋਗਰਾਮ ਦਾ ਆਯੋਜਿਤ ਕੀਤਾ ਜਿਸ ਨਾਲ ਮੈਂ ਕਲਾ ਦੇ ਵੱਖ ਵੱਖ ਪਹਿਲੂਆਂ ਬਾਰੇ ਸਿੱਖਿਆ